ਸਤਿ ਸ਼੍ਰੀ ਅਕਾਲ ਜੀ ਮੈਂ ਹਫਤਾ ਪਹਿਲਾਂ ਨਾ ਇੱਕ ਕੁੜਤੀ ਦਾ ਔਡਰ ਕੀਤਾ ਸੀ ਜਿਹੜਾ ਜਿਹੜੇ ਕਿ ਮੈਂ ਆਪਣੀ ਪੋਤੀ ਵਾਸਤੇ ਮੰਗਵਾਏ ਹੀ ਜਿਹੜਾ ਜਿਹੜਾ ਮੁੰਡਾ ਔਡਰ ਦੇਣ ਆਇਆ ਉਹਨੂੰ ਇੱਕ ਤਾਂ ਬੋਲਣ ਦੀ ਉਹਨੂੰ ਬਿਲਕੁਲ ਵੀ ਜਾਂਚ ਨਹੀਂ ਸੀ ਇੱਕ ਉਹਨੇ ਉਸ ਤੋਂ ਬਾਅਦ ਉਹਨੇ ਮੇਰੇ ਕੋਲੋਂ ਜਿਹੜੀ ਚਾਰ ਸੌ ਰੁਪਏ ਦੀ ਕੁੜਤੀ ਸੀ ਉਹਦੇ ਉਹਨੇ ਮੇਰੇ ਕੋਲੋ ਪੰਜ ਸੌ ਰੁਪਏ ਲਏ ਜਿਹੜਾ ਕਿ ਜੇ ਚਾਰ ਸੌ ਦੀ ਸੀ ਚਾਰ ਸੌ ਹੀ ਲੈਣਾ ਚਾਹੀਦਾ ਸੀ ਉਹ ਪੈਸੇ ਹੀ ਵੱਧ ਲੈ ਗਿਆ ਉਤੋਂ ਉਹਨੇ ਬੋਲਿਆ ਕਿ ਚੱਜ ਨਾਲ ਉਹਨੂੰ ਬਿਲਕੁਲ ਵੀ ਕੋਈ ਵੀ ਬੋਲਣ ਦੀ ਜਾਂਚ ਨਹੀਂ ਏ ਉਸ ਦੂਜੇ ਨੰਬਰ 'ਤੇ ਜਦੋਂ ਮੈਂ ਉਹ ਕੁੜਤੀ ਓਪਨ ਜਦੋਂ ਮੈਂ ਖੋਲ ਕੇ ਵੇਖਿਆ ਪਾਰਸਲ ਤਾਂ ਉਹਦੇ ਵਿੱਚ ਜਿਹੜੀ ਕੁੜਤੀ ਸੀ ਜਿਹੜੀ ਮੰਗਵਾਈ ਹੀ ਉਹ ਨਹੀਂ ਹੀ ਉਹਦੀ ਜਗ੍ਹਾ ਦੂਸਰੀ ਆਈ ਹੀ ਉਹ ਕਲਰ ਵੀ ਉਹ ਨਹੀਂ ਕੱਪੜਾ ਵੀ ਉਹ ਨਹੀਂ ਕੱਪੜਾ ਮੈਂ ਪਿਓਰ ਸੂਤੀ ਮੰਗਵਾਇਆ ਹੀ ਉਹ ਤਾਂ ਮਿਕਸ ਹੀ ਸਨਥੈਟਿਕ ਜਿਹੀ ਕੱਪੜਾ ਸੀ ਕਢਾਈ ਵੀ ਉਹ ਨਹੀਂ ਹੈ ਜਿਹੜੀ ਧਾਗਾ ਏ ਧਾਗਾ ਵੀ ਉਹਨੂੰ ਕੱਚਾ ਧਾਗਾ ਲੱਗਾ ਇਹ ਧਾਗੇ ਸੀਣਾ ਵੀ ਨਹੀਂ ਵਧੀਆ ਲੱਗੀਆਂ ਹੋਈਆਂ ਉਤੋਂ ਬਾਅਦ ਉਹਦੇ ਵਿੱਚ ਜਿੱਥੋਂ ਤੱਕ ਕੱਪੜੇ ਅਤੇ ਉਹਦੇ ਜਿਹੜੇ ਸਾਈਜ਼ ਮੰਗਾਇਆ ਹੀ ਉਹ ਵੀ ਉਹਦੇ ਬਿਲਕੁਲ ਫਿੱਟ ਨਹੀਂ ਹੈ ਮੈਨੂੰ ਬਿਲਕੁਲ ਵੀ ਚੰਗਾ ਨਹੀਂ ਲੱਗਾ ਉਹਦੇ 'ਤੇ ਜਿਹੜੇ ਜਿਹੜਾ ਕਵਰਕ ਕਵਰਕ ਵਰਕ ਕੀਤਾ ਉਹ ਵੀ ਨੀਚ ਕੜਾਈ ਕੀਤੀ ਉਹ ਵੀ ਨਹੀਂ ਬਿਲਕੁਲ ਸਹੀ ਕਲਰ ਵੀ ਨਹੀਂ ਸ ਸੇਮ ਅਤੇ ਇਸ ਕਰਕੇ ਮੈਂ ਉਹ ਕੁੜਤੀ ਨਹੀਂ ਰੱਖਣਾ ਚਾਹੁੰਦੀ ਮੇਰੀ ਪੋਤੀ ਨੂੰ ਵੀ ਪਸੰਦ ਨਹੀਂ ਆਈ ਮੈਂ ਉਹ ਕੁੜਤੀ ਵਾਪਸ ਕਰਨਾ ਚਾਹੁੰਦੀ ਹਾਂ ਚਾਹੁੰਦੀ ਹਾਂ ਕਿਰਪਾ ਕਰਕੇ ਕੁੜਤੀ ਵਾਪਸ ਲਈ ਜਾਏ ਅਤੇ ਮੈਨੂੰ ਮੇਰੇ ਪੈਸੇ ਵਾਪਸ ਕਰ ਦਿਓ ਇਸ ਅਤੇ ਮੈਂ ਤੁਹਾਡੇ ਤੋਂ ਮੈਂ ਤੁਹਾਡੀ ਬਹੁਤ ਮਿਹਰਬਾਨੀ ਹੋਵੇਗੀ